ਮੈਂ ਪਿਛਲੇ ਦਿਨੀਂ ਆਪਣੇ ਪਰਿਵਾਰ ਨਾਲ਼ ਡਲਹੌਜ਼ੀ ਘੁੰਮਣ ਗਈ ਸੀ ਡਲਹੌਜ਼ੀ ਦਾ ਕੁਦਰਤੀ ਅਤੇ ਮਨਮੋਹਕ ਨਜ਼ਾਰਾ ਦੇਖ ਕੇ ਮੈਂ ਬਹੁਤ ਖੁਸ਼ ਹੋਈ ਉੱਥੇ ਦਾ ਮੌਸਮ ਬਹੁਤ ਜ਼ਿਆਦਾ ਵਧੀਆ ਸੀ ਅਤੇ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ ਅਸੀਂ ਉੱਥੇ ਬਹੁਤ ਸਾਰੀਆਂ ਥਾਵਾਂ 'ਤੇ ਘੁੰਮੇ ਅਸੀਂ ਟ੍ਰੈਕਿੰਗ ਵੀ ਕੀਤੀ ਅਤੇ ਅਲੱਗ ਅਲੱਗ ਪਕਵਾਨ ਵੀ ਖਾਧੇ ਲੰਬੇ ਸਮੇਂ ਤੋਂ ਮੈਂ ਕੰਮ ਤੋਂ ਛੁੱਟੀ ਨਾ ਹੋਣ ਕਰਕੇ ਘੁੰਮਣ ਲਈ ਨਾ ਜਾ ਸਕੀ ਆਰਾਮਦਾਇਕ ਮਾਹੌਲ ਅਤੇ ਕੰਮ ਤੋਂ ਥੋੜ੍ਹੀ ਦੂਰ ਰਹਿਣਾ ਚਾਹੁੰਦੀ ਸੀ ਇਸ ਲਈ ਮੈਂ ਇੱਕ ਹਫ਼ਤੇ ਦੀ ਛੁੱਟੀ ਲੈ ਕੇ ਕਿਸੇ ਸੋਹਣੀ ਅਤੇ ਕੁਦਰਤੀ ਨਜ਼ਾਰਿਆਂ ਵਾਲ਼ੀ ਜਗ੍ਹਾ ਡਲਹੌਜ਼ੀ ਗਈ ਸੀ ਅਤੇ ਮੈਂ ਉੱਥੇ ਬਹੁਤ ਆਨੰਦ ਮਾਣਿਆ